ਕੁਝ ਦਿਨ ਪਹਿਲੇ ਮੈਂ ਡੀਮਾਰਟ ਤੋਂ ਕੁਝ ਬਰਤਨ ਲਿਆਈ ਸੀ ਜੋ ਬਹੁਤ ਅੱਛੇ ਨਿਕਲੇ ਜਿਸ ਤਰ੍ਹਾਂ ਕਿ ਕੁੱਕਰ ਬਹੁਤ ਬੈਸਟ ਨਿਕਲਿਆ ਉੱਤੇ ਮਤਲਬ ਢੱਕਣ ਲੀਡ ਵਗੈਰਾ ਬਹੁਤ ਅੱਛੀ ਨਿਕਲੀ ਔਰ ਕੁਛ ਮੈਂ ਕਰੋਕਰੀ ਲਿਆਈ ਸੀ ਜਿਸ ਤਰਾਂ ਕੱਪ ਹੋ ਗਏ ਕੱਪ ਵੀ ਬਹੁਤ ਅੱਛੇ ਨਿਕਲੇ ਕੋਫੀ ਮੱਗ ਸੀ ਇਸ ਤੋਂ ਇਲਾਵਾ ਕਾਫੀ ਬਰਤਨ ਜਿਸ ਤਰ੍ਹਾਂ ਮੈਂ ਪੂਰੀ ਮਤਲਬ ਕਰੋਕਰੀ ਲੈ ਕੇ ਆਈ ਸੀ ਘਰ ਦੀ ਜੋ ਬਹੁਤ ਅੱਛੀ ਨਿਕਲੀ ਔਰ ਵਧੀਆ ਰਹੀ ਕਰੋਕਰੀ ਆਪਾਂ ਨੂੰ ਹਮੇਸ਼ਾ ਮਤਲਬ ਅੱਛੀ ਕੁਆਲਿਟੀ ਦੇ ਬਰਤਨ ਲੈਣੇ ਚਾਹੀਦੇ ਆ ਜੋ ਬੈਸਟ ਰਹਿੰਦੇ ਘਰ ਵਸਤੇ ਜਿਹਨਾਂ ਵਿੱਚ ਕਾਣਾ ਖਾਣਾ ਵੀ ਹਾਈਜੀਨਿਕ ਰਹਿੰਦਾ ਔਰ ਅੱਛਾ ਮਤਲਬ ਰਹਿੰਦਾ ਮੈਂ ਜਿਸ ਤਰ੍ਹਾਂ ਲਏ ਸੀ ਪਲਾਸਟਿਕ ਦੇ ਡੋਂਗੇ ਉਹ ਬਹੁਤ ਅੱਛੇ ਨੇ ਫਰਿੱਜ ਵਗੈਰਾ ਵਿੱਚ ਰੱਖਣ ਦੇ ਵੀ ਕੰਮ ਆਉਂਦੇ ਨੇ ਔਰ ਮਾਈਕਰੋ ਵਿੱਚ ਵੀ ਚਲ ਜਾਂਦੇ ਆ ਆਪਣੇ ਮਾਈਕਰੋ ਵਿੱਚ ਗਰਮ ਕਰਨ ਦੇ ਵਾਸਤੇ ਸਬਜ਼ੀ ਵਾਸਤੇ ਵੀ ਯੂਜ਼ 'ਚ ਆ ਜਾਂਦੇ ਆ ਔਰ ਫਰਿੱਜ 'ਚ ਵੀ ਆਪਾਂ ਉਹਨਾਂ ਵਿੱਚ ਖਾਣਾ ਰੱਖ ਸਕਦੇ ਔਰ ਉਹਨਾਂ ਵਿੱਚ ਆਪਾਂ ਖਾਣਾ ਸਰਵ ਵੀ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਸਿਰਫ ਉਹ ਗਰਮ ਕਰਨ ਦੇ ਵਾਸਤੇ ਹੀ ਯੂਜ਼ ਆਉਂਦੇ ਆਪਾਂ ਉਹਨਾਂ ਵਿੱਚ ਸਰਵ ਵੀ ਕਰ ਸਕਦੇ ਹਾਂ ਦੇਖਣ 'ਚ ਵੀ ਬਹੁਤ ਸੁੰਦਰ ਲੱਗਦੇ ਨੇ ਜਿਸ ਤਰ੍ਹਾਂ ਉਹਦੇ 'ਤੇ ਡਾਇਨਿੰਗ ਵਗੈਰਾ 'ਤੇ ਪਏ ਵੀ ਬਹੁਤ ਸੋਹਣੇ ਲੱਗਦੇ ਨੇ ਉਹ